ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਪ੍ਰੀਤ ਬੱਸ ਸਰਵਿਸ ਤੋਂ ਬੋਲ ਰਹੇ ਹੋਂ ਮੈਂ ਆਪਣੀ ਮਾਸੀ ਦੀ ਕੁੜੀ ਜੋ ਕਿ ਮੇਰੀ ਵੱਡੀ ਭੈਣ ਲੱਗਦੀ ਹੈ ਉਸਦੇ ਵਿਆਹ 'ਤੇ ਜਾਣਾ ਹੈ ਅਤੇ ਉਸਦੇ ਵਿਆਹ 'ਤੇ ਜਾਣ ਲਈ ਮੈਂ ਮੈਂ ਇਹ ਪੁੱਛਣਾ ਸੀ ਕਿ ਤੁਹਾਡੇ ਕੋਲ਼ ਕੋਈ ਕਾਰ ਜਾਂ ਕੈਬ ਬੁੱਕ ਕਰ ਸਕਦੇ ਹਾਂ ਜਿਸ ਰਾਹੀਂ ਅਸੀਂ ਉਸਦੇ ਪਿੰਡ ਤੱਕ ਜਾ ਸਕੀਏ ਉਸਦਾ ਪਿੰਡ ਅਯੋਨ ਹੈ ਅਤੇ ਉੱਥੋਂ ਅਸੀਂ ਰਾਤ ਨੂੰ ਮੁੜ ਕੇ ਵੀ ਆਉਣਾ ਹੈ ਅਤੇ ਰਸਤੇ ਵਿੱਚ ਜਾਂਦਿਆਂ ਅਸੀਂ ਆਪਣੇ ਕੁ ਇੱਕ ਦੋ ਰਿਸ਼ਤੇਦਾਰਾਂ ਨੂੰ ਵੀ ਆਪਣੇ ਨਾਲ਼ ਲੈ ਕੇ ਜਾਣਾ ਹੈ ਅਤੇ ਇਨ ਸਾਰੀ ਚੀਜ਼ ਇਸ ਸਾਰਿਆਂ ਦਾ ਖਰਚਾ ਸਾਨੂੰ ਦੱਸਿਆ ਜਾਵੇ ਅਤੇ ਅਸੀਂ ਜਾਣਾ ਹੈ ਮਿਤੀ ਵੀਹ ਅਕਤੂਬਰ ਨੂੰ ਉੱਥੇ ਪਹੁੰਚਣਾ ਹੈ ਅਤੇ ਸਾਨੂੰ ਇਹਨਾਂ ਸਾਰੀ ਚੀਜ਼ਾਂ ਦਾ ਖਰਚਾ ਦੱਸਿਆ ਜਾਵੇ ਧੰਨਵਾਦ